ਮੇਰੇ ਇਲਾਕੇ ਵਿੱਚ ਬਹੁਤ ਸਾਰੇ ਪੰਛੀ ਹਨ ਜਿਵੇਂ ਕਿ ਮੋਰ ਕਬੂਤਰ ਅਤੇ ਬਹੁਤ ਸਾਰੀਆਂ ਚਿੜੀਆਂ ਜਿਨ੍ਹਾਂ ਵਿੱਚੋਂ ਮੇਰਾ ਮਨਪਸੰਦ ਪੰਛੀ ਮੋਰ ਹੈ ਅਤੇ ਇਹ ਬਹੁਤ ਹੀ ਸੋਹਣਾ ਨੱਚਦਾ ਹੈ ਅਤੇ ਬਹੁਤ ਹੀ ਸੋਹਣਾ ਲੱਗਦਾ ਹੈ